ਸੁਹਾਗ ਇੱਕ ਪੰਜਾਬੀ ਲੋਕ ਗੀਤ ਹੈ ਇਹ ਗੀਤ ਆਮ ਤੌਰ 'ਤੇ ਵਿਆਹ ਸ਼ਾਦੀਆਂ ਦੇ ਗਾਏ ਜਾਂਦੇ ਹਨ ਇਹ ਲੋਕ ਗੀਤ ਪੰਜਾਬ 'ਚ ਹੀ ਗਾਇਆ ਜਾਂਦਾ ਹੈ ਜਾਂ ਪੰਜਾਬੀ ਜਿੱਥੇ ਵੱਸਦੇ ਨੇ ਉੱਥੇ ਸੁਹਾਗ ਲੋਕ ਗੀਤ ਗਾਉਂਦੇ ਹਨ ਇਹ ਲੋਕ ਗੀਤ ਖੁਸ਼ੀ ਅਤੇ ਮੌਕੇ 'ਤੇ ਜਿਵੇਂ ਕਿ ਕੁੜੀ ਦੇ ਵਿਆਹ ਦੇ ਮੁੰਡੇ ਦੇ ਵਿਆਹ 'ਤੇ ਹੀ ਇਹ ਸੁਹਾਗ ਗੀਤ ਗਾਏ ਜਾਂਦੇ ਹਨ ਇਹ ਪੰਜਾਬ ਦੇ ਮੁੱਖ ਅਤੇ ਪ੍ਰਮੁੱਖ ਲੋਕ ਗੀਤ ਹਨ